ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਨੂੰ ਕਈ ਅਹਿਮ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਰਨਾ ਪੈਂਦਾ ਹੈ ਕਾਰੀਗਰ ਅਕਸਰ ਵੱਡੇ ਪੱਧਰ 'ਤੇ ਤਿਆਰ ਕੀਤੀਆਂ ਵਸਤੂਆਂ ਜੋ ਕਿ ਸਸਤੇ ਅਤੇ ਵਧੇਰੇ ਪਹੁੰਚਯੋਗ ਹੁੰਦੇ ਹਨ ਦੇ ਮੁਕਾਬਲੇ ਨਾਲ ਸੰਘਰਸ਼ ਕਰਦੇ ਹਨ ਜੋ ਰਵਾਇਤੀ ਦਸਤਕਾਰੀ ਚੀਜ਼ਾਂ ਦੀ ਮੰਗ ਨੂੰ ਘਟਾਉਂਦੇ ਹਨ ਆਰਥਿਕ ਵਿਵਹਾਰ ਕਰਤਾ ਇੱਕ ਹੋਰ ਅਹਿਮ ਮੁੱਦਾ ਹੈ ਕਿਉਂਕਿ ਬਹੁਤ ਸਾਰੇ ਕਾਰੀਗਰ ਘੱਟ ਉਜਰਤਾਂ ਅਤੇ ਨਾਕਾਢੇ ਆਮਦਨ ਨਾਲ ਜੂਝਦੇ ਹਨ ਜਿਸ ਨਾਲ ਉਹਨਾਂ ਦੀ ਕਲਾ ਨੂੰ ਕਾਇਮ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਵਿਸ਼ਾਲ ਬਜ਼ਾਰਾਂ ਦਾ ਸੀਮਿਤ ਪਹੁੰਚ ਇਹਨਾਂ ਬੀਤੀਆਂ ਚੁਣੌਤੀਆਂ ਨੂੰ ਹੋਰ ਵਧਾ ਦਿੰਦੀ ਹੈ ਕਾਰੀਗਰਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਾਹਕਾਂ ਤੱਕ

ਸੁਰੱਖਿਤ ਰੱਖਣ ਦੇ ਯਤਨਾਂ ਵਿੱਚ ਰੁਕਾਵਟ ਪਾਉਂਦਾ ਹੈ ਕੁਝ ਮਾਮਲਿਆਂ ਵਿੱਚ ਪਹਾੜੀ ਜਾਂ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਮੁੱਦੇ ਉਤਪਾਦਨ ਅਤੇ ਵੰਡ ਨੂੰ ਗੁੰਜਲਦਾਰ ਬਣਾਉਂਦੇ ਹਨ ਜਿਸ ਨਾਲ ਸੈਕਟਰ ਦੀ ਆਰਥਿਕਤਾ ਵਧਦੀ ਹੈ ਇਹਨਾਂ ਚੁਣੌਤੀਆਂ ਨੂੰ ਸੰਬੋਧਨ ਕਰਨ ਲਈ ਇੱਕ ਬਹੁ ਪੱਖੀ ਪਹੁੰਚ ਦੀ ਲੋੜ ਹੈ ਜਿਸ ਵਿੱਚ ਬਿਹਤਰ ਮਾਰਕੀਟ ਪਹੁੰਚ ਬਿਹਤਰ ਵਿੱਤੀ ਸਹਾਇਤਾ ਅਤੇ ਰਵਾਇਤੀ ਕਲਾਵਾਂ ਅਤੇ ਸ਼ਿਲਪਕਾਰੀ ਦੇ ਸੱਭਿਆਚਾਰਕ ਅਤੇ ਆਰਥਿਕ ਮੁੱਲ ਦੀ ਵਧੀ ਹੋਈ ਮਾਨਤਾ ਸ਼ਾਮਿਲ ਹੈ